ਮੈਨੂੰ ਲਿਖਣਾ ਬਹੁਤ ਪਸੰਦ ਹੈ ਮੈਂ ਆਪਣੇ ਬੱਚੇ ਦਾ ਇੱਕ ਡਾਇਰੀ ਲਗਾਈ ਹੈ ਜਿੱਦਾਂ ਉਹ ਪੈਦਾ ਹੋਇਆ ਲਿਖਿਆ ਵੱਡਾ ਹੋਇਆ ਉਹ ਕੀ ਕੀ ਸ਼ਰਾਰਤਾਂ ਕਰਦਾ ਸੀ ਉਹ ਕੀ ਕੀ ਬੋਲਦਾ ਸੀ ਕਿਸ ਟਾਈਮ 'ਤੇ ਉਹਨੂੰ ਪਹਿਲੀ ਵਾਰੀ ਸਕੂਲ ਭੇਜਿਆ ਬਸਤਾ ਉਹਦਾ ਕਿਹੜੇ ਰੰਗ ਦਾ ਸੀ ਕਿਤਾਬਾਂ ਵਿੱਚ ਕਿੰਨੀਆਂ ਸੀ ਇਹ ਚੀਜ਼ਾਂ ਮੈਂ ਲਿਖੀਆਂ ਹਨ ਹੋਰ ਜੋ ਸਮਾਜ ਨੂੰ ਦੱਸਣਾ ਚਾਹੁੰਦੇ ਹਾਂ ਉਹ ਇਹ ਚੀਜ਼ਾਂ ਹਨ ਕਿ ਜਿਹੜੇ ਆਪਣੇ ਲੀਡਰ ਨੇ ਜਾਂ ਪੁਲਿਸ ਅਫਸਰ ਨੇ ਜਾਂ ਵੱਡੀਆਂ ਪੋਸਟਾਂ 'ਤੇ ਬੈਠੇ ਨੇ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ ਗਲਤ ਕੰਮ ਨਾ ਕਰੋ ਸਾਫ ਸੁਥਰੇ ਤਰੀਕੇ ਨਾਲ ਜ਼ਿੰਦਗੀ ਜੀਓ ਅਤੇ ਬਾਕੀਆਂ ਨੂੰ ਵੀ ਜੀਣ ਦਿਉ ਸਟਾਰਟਿੰਗ ਜਿਹੜੀ ਹੈ ਜਿਹੜੀ ਸ਼ੁਰੂਆਤ ਹੁੰਦੀ ਹੈ ਉਹ ਹਮੇਸ਼ਾ ਥੱਲੜੇ ਪਾਸਿਉਂ ਹੁੰਦੀ ਹੈ ਪਰ ਲੋਕਾਂ ਨੂੰ ਪੈਸੇ ਦਾ ਇੰਨਾ ਕੁ ਜ਼ਿਆਦਾ ਚਾਅ ਚੜ੍ਹਿਆ ਹੋਇਆ ਜਾਂ ਉਸਨੂੰ ਇੰਨਾ ਕੁ ਜ਼ਿਆਦਾ ਇਕੱਠਾ ਕਰਨਾ ਚਾਹੁੰਦੇ ਨੇ ਕਿ ਵੀ ਬਸ ਜਿਵੇਂ ਰਹਿਣਾ ਹੀ ਸਾਰੀ ਹੋਈ ਜ਼ਿੰਦਗੀ ਇੱਥੇ ਹੀ ਹੈ ਅੱਗੇ ਵੀ ਜਾਣਾ ਮਰਨਾ ਵੀ ਹੁੰਦਾ ਉਸ ਤੋਂ ਬਾਅਦ 'ਚ ਦੁਬਾਰਾ ਫਿਰ ਜਨਮ ਰੱਬ ਦਿੰਦਾ ਹੈ ਉਸ 'ਤੇ ਫਿਰ ਮਿਹਨਤ ਕਰਨੀ ਪੈਂਦੀ ਹੈ ਰੋਜ਼ ਦੇ ਰੋਜ਼ ਮਿਹਨਤ ਕਰਕੇ ਜੋ ਖਾਂਦਾ ਹੈ ਉਹ ਬਹੁਤ ਵਧੀਆ ਅਤੇ ਸਾਫ ਸੁਥਰੀ ਜ਼ਿੰਦਗੀ ਜਿਉਂਦਾ ਹੈ ਅਤੇ ਜਿਹਨੇ ਠੱਗੀਆਂ ਮਾਰਨੀਆਂ ਹਨ ਜਾਂ ਜ਼ਿਆਦਾ ਪੈਸਾ ਇਕੱਠਾ ਕਰਨਾ ਹੈ ਉਹਦਾ ਕੋਈ ਫਾਇਦਾ ਨਹੀਂ ਹੈ